ਹੈਲੋ ਸਤਿ ਸ਼੍ਰੀ ਅਕਾਲ ਭਰਾ ਜੀ ਮੈਂ ਨਾ ਮੁੰਬਈ ਤੋਂ ਆਇਆਂ ਜੀ ਪੰਜਾਬ ਘੁੰਮਣ ਦੇ ਲਈ ਅਤੇ ਹੁਣ ਮੈਂ ਲਗਾਤਾਰ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਅਤੇ ਮੇਰਾ ਜਿਹੜਾ ਇੰਟਰਸਟ ਹੈ ਉਹ ਪੰਜਾਬ ਦੀ ਜਿਹੜਾ ਮਿਊਜਿਕ ਇੰਡਸਟਰੀ ਹੈ ਗਾਇਕੀ ਹੈ ਜੀ ਉਹਦੇ ਵਿੱਚ ਬਹੁਤ ਹੈ ਮੈਂ ਪੁੱਛਣਾ ਚਾਹੁੰਦਾ ਸੀਗਾ ਜੀ ਕਿ ਪੰਜਾਬ ਦੇ ਜਿਹੜੇ ਮਸ਼ਹੂਰ ਗਾਇਕ ਨੇ ਜਾਂ ਮਿਊਜ਼ਿਕ ਘਰਾਣੇ ਹੋਣਗੇ ਇੱਥੇ ਕੋਈ ਉਹਨਾਂ ਬਾਰੇ ਮੈਨੂੰ ਕੋਈ ਜਾਣਕਾਰੀ ਮਿਲ ਸਕਦੀ ਹੈ ਜੀ

ਠੀਕ ਹੈ ਜੀ ਠੀਕ ਹੈ ਜੀ ਅਤੇ ਇਹ ਹੈਗੇ ਨੇ ਜੀ ਹੁਣ ਠੀਕ ਆ ਜੀ

ਠੀਕ ਆ ਜੀ ਠੀਕ ਆ ਜੀ ਠੀਕ ਹੈ ਜੀ ਅਤੇ ਜਿਹੜੇ ਨਵੇਂ ਹੁਣ ਮੁੰਡੇ ਉੱਠ ਰਹੇ ਨੇ ਜੀ ਇਹਨਾਂ ਚੋਂ ਕੋਈ ਹੋਵੇ ਜਿਹੜਾ ਚੰਗਾ ਗਾਉਂਦਾ ਹੋਵੇ ਪੰਜਾਬ ਦੇ ਲੀਡਰਾਂ ਦਾ ਹੋਵੇ ਜਾਂ ਮਸ਼ਹੂਰ ਹੋਵੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੱਛਾ ਜੀ ਉਹ ਵੀ ਹੈ ਠੀਕ ਹੈ ਅਤੇ ਮੇਰਾ ਨਾ ਜੀ ਬੇਟਾ ਪਲੱਸ ਟੂ ਦੇ ਵਿੱਚ ਹੈ ਅਤੇ ਮੈਂ ਅੱਗੇ ਉਹਨੂੰ ਮਿਊਜਿਕ ਵਾਲੀ ਲਾਈਨ ਦੇ ਵਿੱਚ ਹੀ ਪਾਉਣਾ ਚਾਹੁੰਦਾ ਅਤੇ ਪਲੱਸ ਟੂ ਤੋਂ ਬਾਅਦ ਮੈਨੂੰ ਦੱਸੋ ਕਿ ਉਹ ਕਿੱਥੇ ਲਾਈਏ ਉਹਨੂੰ ਅੱਛਾ ਜੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਜੀ ਠੀਕ ਹੈ ਜੀ ਓਕੇ ਧੰਨਵਾਦ